ਸਤਿ ਸ਼੍ਰੀ ਅਕਾਲ ਮੇਰੀ ਨਾਨੀ ਨੂੰ ਮੈਂ ਦੇਖਦੀ ਹੁੰਦੀ ਸੀ ਉਹ ਬਚਪਨ ਤੋਂ ਹੀ ਬੁਣਾਈ ਅਤੇ ਸਿਲਾਈ ਕਰਦੇ ਹੁੰਦੇ ਸੀਗੇ ਪਰ ਮੈਂ ਬਚਪਨ 'ਚ ਕੋਸ਼ਿਸ਼ ਕਰਦੀ ਸੀ ਪਰ ਮੈਂ ਇੰਨੀ ਵਧੀਆ ਤਰੀਕੇ ਨਾਲ਼ ਨਹੀਂ ਕਰ ਸਕਦੀ ਸੀ ਹਲੇ ਵੀ ਮੈਂ ਵਧੀਆ ਤਰੀਕੇ ਨਾਲ਼ ਨਹੀਂ ਕਰ ਸਿੱਖ ਪਾਈ ਹਾਂ ਪੰਜਾਬ ਦੇ ਕਈ ਖ਼ਾਸ ਬੁਣਾਈ ਅਤੇ ਕਈ ਸਾਰੇ ਵਧੀਆ ਲੋਕਪ੍ਰਿਯ ਤਕਨੀਕ ਹੈਗੇ ਆ ਜਿੱਦਾਂ ਕਿ ਹੈਗੀ ਆ ਫੁਲਕਾਰੀ ਫੁਲਕਾਰੀ ਜਿਹੜੀ ਵਾਈਬ੍ਰੈਂਟ ਰੰਗ ਦੇ ਕੱਠੇ 'ਤੇ ਬੰਧੀ ਜਾਂਦੀ ਆ ਉਹ ਪੰਜਾਬੀ ਅਤੇ ਨੌਰਥ ਇੰਡੀਅਨ ਵਿਰਾਸਤ ਦਾ ਇੱਕ ਇੰਪੋਰਟੈਂਟ ਹਿੱਸਾ ਏ ਇਹ ਤਕਨੀਕ ਪੈਟਰਨ ਅਤੇ ਡਿਜ਼ਾਇਨ ਵਿੱਚ ਕੀ ਜਾਂਦੀ ਆ ਕਈ ਸਾਰੇ ਪ੍ਰਮੁੱਖ ਪੈਟਰਨ ਦੇ ਟਕਨੀਕ ਦੀ ਮੈਂ ਤੁਹਾਨੂੰ ਝਲਕ ਦਿਖਾਉਂਦੀ ਆ ਦੱਸਦੀ ਹਾਂ ਜਿੱਦਾਂ ਕਿ ਵਿਸਾਖੀ ਫੁਲਕਾਰੀ ਵਿਸਾਖੀ ਫੈਸਟੀਵਲ 'ਤੇ ਫੁਲਕਾਰੀਆਂ 'ਚ ਖ਼ਾਸ ਰੰਗ ਹੁੰਦੇ ਨੇ ਲਲਚਾਈਆਂ ਮੋਰ ਅਤੇ ਸੱਪ ਦੀ ਅੱਕਰ ਦੇ ਪੈਟਰਨ ਇਸ ਫੁਲਕਾਰੀ ਵਿੱਚ ਦੇਖੇ ਜਾ ਸਕਦੇ ਆ ਦੂਜੀ ਚੋਪੇ ਫੁਲਕਾਰੀ ਇਹ ਪੈਟਰਨ ਆਮ ਤੌਰ 'ਤੇ ਬਲੈਕ ਬੈਕਗਰਾਊਂਡ ਅਤੇ ਬਰਾਈਟ ਰੰਗ ਵਾਲੇ ਥਰੈਡਸ ਦੀ ਯੂਜ ਨਾਲ਼ ਬਣਾਇਆ ਜਾਂਦਾ ਹੈ ਚੋਪੇ ਫੁਲਕਾਰੀ 'ਚ ਜੁਮੈਟਰਿਕਲ ਸ਼ੇਪਸ ਅਤੇ ਪੈਟਰਨ ਹੁੰਦੇ ਨੇ ਤੀਜਾ ਦਰਸ਼ਨ ਦੁਆਰ ਫੁਲਕਾਰੀ ਇਸ ਪੈਟਰਨ 'ਚ ਇੱਕ ਇਕੱਠ ਚੱਕਰ ਬਣਾਇਆ ਜਾਂਦਾ ਹੈ ਜੋ ਦਰਸ਼ਨ ਦੁਆਰ ਨੂੰ ਦਰੁਸਤ ਕਰਨ ਲਈ ਯੂਜ਼ ਹੁੰਦਾ ਹੈ ਚੌਥਾ ਨਕਸ਼ੀ ਫੁਲਕਾਰੀ ਇਸ ਪੈਟਰਨ 'ਚ ਫੁਲਕਾਰੀ ਦੀ ਤਕਨੀਕ ਨਾਲ਼ ਇਕੱਠਾ ਦਸਤਾ ਕਹਾਣੀ ਇਹ ਲੋਕ ਵਿਰਾਸਤ ਨੂੰ ਦਰੁਸਤ ਕਰਨ ਲਈ ਯੂਜ ਹੁੰਦਾ ਹੈ ਪੰਜਵਾਂ ਸੈਂਚੀ ਫੁਲਕਾਰੀ ਸੈਂਚੀ ਫੁਲਕਾਰੀ 'ਚ ਇੱਕ ਦੂਸਰੇ ਅਤੇ ਘਰੇਲੂ ਜੀਵਨ ਅਤੇ ਲੋਕ ਸੰਸਕ੍ਰਿਤੀ ਨਾਲ਼ ਜੁੜੀਆਂ ਭਾਵਨਾਵਾਂ ਬਣਾਏ ਜਾਂਦੀ ਨੇ ਹਰੇਕ ਪੈਟਰਨ 'ਚ ਆਪਣੀ ਆਪਣੀ ਪਹਿਚਾਣ ਹੈ ਅਤੇ ਫੁਲਕਾਰੀ ਦੀ ਤਕਨੀਕ ਵਿੱਚ ਆਪਣੇ ਆਪਣੇ ਵਿਰਾਸਤ ਅਤੇ ਮਹੱਤਵ ਨੇ ਇਹ ਭੁੱਲ ਜਾਵੇ ਕਿ ਫੁਲਕਾਰੀ ਦੇ ਇਲਾਵਾ ਕੋਈ ਹੋਰ ਬੁਣਾਈ ਦੀ ਤਰੀਕੇ ਵੀ ਹੈਗੇ ਆ ਭਾਰਤ ਅਤੇ ਪੰਜਾਬ ਵਿੱਚ ਪਰ ਅਸੀਂ ਕਦੇ ਵੀ ਸਾਨੂੰ ਆਪਣਾ ਵਿਰਾਸਤ ਨਹੀਂ ਭੁੱਲਣਾ ਚਾਹੀਦਾ ਹੈ ਧੰਨਵਾਦ ਜੀ